ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹਰ ਚੀਜ਼ ਵਿੱਚ ਸਫਲਤਾ ਹੋਣੀ ਬਹੁਤ ਹੀ ਜ਼ਰੂਰੀ ਹਨ ਹਰ ਮਨੁੱਖ ਕੋਈ ਵੀ ਕਾਰਯਕਾ ਕੋਈ ਵੀ ਕੰਮ ਕਾਰ ਕਰਦਾ ਹੈ ਤਾਂ ਉਹਦਾ ਆ ਹੀ ਮਕਸਦ ਹੁੰਦਾ ਕਿ ਉਹਨੂੰ ਸਫਲਤਾ ਜ਼ਰੂਰ ਹੋਵੇ ਹਰ ਖੇਤਰ ਵਿੱਚ ਸਫਲਤਾ ਦਾ ਸਾਧਨ ਹੋਣਾ ਜ਼ਰੂਰੀ ਆ ਸਾਡੇ ਵੀ ਖੇਤਰ ਵਿੱਚ ਬਹੁਤ ਸਾਰੇ ਇੱਦਾਂ ਦੇ ਤਕਨੀਕੀ ਸਰੋਤ ਜਾਂ ਸਾਧਨ ਹਨ ਜ਼ਰੂਰੀ ਹਨ ਜਿੰਨ੍ਹਾਂ ਕਰਕੇ ਸਾਨੂੰ ਸਫਲਤਾ ਪ੍ਰਾਪਤ ਹੁੰਦੇ ਹਨ ਸਕੂਲਾਂ ਕਾਲਜਾਂ ਵਿੱਚ ਅੱਜ ਕੱਲ੍ਹ ਦੇ ਸਕੂਲ ਬਹੁਤ ਹੀ ਮਾਡਰਨ ਹੋ ਗਏ ਨੇ ਬਹੁਤ ਹੀ ਨਵੇਂ ਜ਼ਮਾਨੇ ਦੇ ਹੋ ਗਏ ਨੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਬਲੈਕਬੋਰਡ ਦੀ ਬਲੈਕਬੋਰਡ ਨੂੰ ਛੱਡ ਕੇ ਬਲੈਕਬੋਰਡ ਦੀ ਜਗ੍ਹਾ ਉਹਨਾਂ ਨੂੰ ਸਕਰੀਨਾਂ 'ਤੇ ਪੜ੍ਹਾਇਆ ਜਾਂਦਾ ਹਨ ਉਹਨਾਂ ਨੂੰ ਵੀਡੀਓ ਕਾਨਫਰਸਿੰਗ 'ਤੇ ਪੜ੍ਹਾਇਆ ਜਾਂਦਾ ਹਨ ਕਈ ਇੱਦਾਂ ਦੇ ਕੰਪਨੀਆਂ ਵੀ ਹੈ ਕਈ ਇੱਦਾਂ ਦੇ ਆਫਿਸ ਵੀ ਹੈ ਕਈ ਕੰਮ ਵੀ ਇੱਦਾਂ ਦੇ ਹੈ ਜਿਹਦੇ ਨਾਲ ਮੀਟਿੰਗਸ ਕਰਨ ਲਈ ਵੀਡੀਓ ਕਾਨਫਰਸਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਸੀ ਆਈ ਪੀ ਇੰਸਿਕਿਉਰਿਟੀ ਡਿਜੀਟਲ ਮਾਰਕੀਟਿੰਗ ਇਹ ਸਾਰੇ ਇਹਦੇ ਹੀ ਖੇਤਰ ਹਨ ਇਹਦੇ ਹੀ ਪਾਤਰ ਹਨ ਇਹਨਾਂ ਸਾਰਿਆਂ ਰਾਹੀਂ ਸਫਲਤਾ ਹੁੰਦੀ ਹੈ ਇਹ ਬਹੁਤ ਜ਼ਰੂਰੀ ਹਨ ਇਹਨਾਂ ਸਾਰਿਆਂ ਰਾਹੀਂ ਹੀ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਹਨ ਵੀਡੀਓ ਕਾਨਫਰਸਿੰਗ ਇਹ ਸਾਰੇ ਹੀ ਇਹ ਸਾਰੇ ਹੀ ਤਕਨੀਕੀ ਸਰੋਤ ਜਾਂ ਸਾਧਨ ਜ਼ਰੂਰੀ ਹਨ ਸਾਡੇ ਲਈ ਇਹਨਾਂ ਨਾਲ ਹੀ ਸਫਲਤਾ ਸਾਨੂੰ ਪ੍ਰਾਪਤ ਹੁੰਦੀ ਹਨ ਕਈ ਹੋਸਪਿਟਲਾਂ ਵਿੱਚ ਵੀ ਡਾਕਟਰ ਓਪਰੇਸ਼ਨ ਕਰਨ ਲਈ ਮਰੀਜ਼ ਨੂੰ ਸਕਰੀਨ ਉੱਤੇ ਦਿਖਾਉਂਦੇ ਹਨ ਜਾਂ ਕਈ ਉਹਨਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਸਕਰੀਨ ਉੱਤੇ ਦਿਖਾਈਆਂ ਜਾਂਦੀਆਂ ਹਨ ਜਿਹੜੀ ਡਿਜੀਟਲ ਰਾਹੀਂ ਉਹਨਾਂ ਨੂੰ ਦਿਖਾਈ ਜਾਂਦੀ ਹੈ ਜਿਹਦੇ ਕਰਕੇ ਉਹ ਚੰਗੀ ਤਰ੍ਹਾਂ ਮਰੀਜ਼ ਦਾ ਇਲਾਜ ਕਰ ਸਕਦੇ ਹਨ ਡਾਕਟਰਾਂ ਨੂੰ ਵੀ ਇਹਨਾਂ ਸਭ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਸਫਲਤਾ ਦੇ ਲਈ